ਕੀ ਤੁਹਾਨੂੰ ਘਰ ਘਰ ਸਿੱਖਿਆ ਕਾਰੋਬਾਰ ਖੇਤੀ ਵਿਅਕਤੀਗਤ ਆਦਿ ਲਈ ਕਰਜ਼ਾ ਲੈਣਾ ਪਿਆ ਸ਼ੁਰੂਆਤ ਦੇ ਵਿੱਚ ਕੀਤਾ ਕੀ ਸੀ ਮੈਂ ਬਾਰਵੀਂ ਕਰਨ ਤੋਂ ਬਾਅਦ ਮੈਂ ਕੋਲਜ ਵਿੱਚ ਪੈ ਗਿਆ ਅਤੇ ਕੋਲਜ ਵਿੱਚ ਪੜ੍ਹਾਈ ਕਰਨ ਦੇ ਨਾਲ ਨਾਲ ਮੈਂ ਇੱਕ ਸਾਈਡ ਬਿਜਨਸ ਵੀ ਕਰਦਾ ਸੀ ਸਾਈਡ ਬਿਜਨਸ ਨਾਲ ਜਿਹੜਾ ਮੈਨੂੰ ਪੈਸੇ ਮਿਲਦੇ ਸਨ ਉਹ ਮੈਂ ਬਚਾ ਕੇ ਰੱਖ ਲੈਂਦਾ ਅਤੇ ਬੈਂਕ ਵਿੱਚ ਸੇਵ ਕਰ ਦਿੰਦਾ ਇੱਦਾਂ ਹੀ ਕਰਦੇ ਕਰਦੇ ਮੇਰੇ ਤੋਂ ਕੁਛ ਪੈਸੇ ਇਕੱਠੇ ਹੋ ਗਏ ਫਿਰ ਮੇਰੀ ਜਦੋਂ ਡਿਗਰੀ ਖਤਮ ਹੋਈ ਫਿਰ ਮੈਂ ਆਪਣੇ ਦੋਸਤਾਂ ਨੂੰ ਕਿਹਾ ਕਿ ਚੱਲੋ ਹੁਣ ਅਸੀਂ ਬੇਰੁਜ਼ਗਾਰ ਹੀ ਹੈਗੇ ਹਾਂ ਇਸ ਕਰਕੇ ਮੈਂ ਉਹਨਾਂ ਨੂੰ ਕਿਹਾ ਕਿ ਮੇਰੇ ਨਾਲ ਇੱਕ ਨਵਾਂ ਬਿਜਨਸ ਸਟਾਰਟ ਕਰਨ ਉਹ ਮੇਰੀ ਗੱਲ ਨਾਲ ਬਹੁਤ ਹੀ ਸਹਿਮਤ ਹੋਏ ਕਿਉਂਕਿ ਅਸੀਂ ਬਹੁਤ ਪੜ੍ਹੇ ਲਿਖੇ ਹੋ ਚੁੱਕੇ ਸੀ ਇਸ ਟਾਈਮ ਤੱਕ ਅਤੇ ਅਸੀਂ ਕਿਹਾ ਕਿ ਸਾਡੀ ਪੜ੍ਹਾਈ ਸਭ ਤੋਂ ਵਧੀਆ ਸਾਡਾ ਹਥਿਆਰ ਹੈ ਇਸ ਲਈ ਮੈਂ ਉਹਨਾਂ ਨੂੰ ਕਿਹਾ ਕਿ ਅਸੀਂ ਟਿਊਸ਼ਨ ਸੈਂਟਰ ਖੋਲਦੇ ਹਾਂ ਉਹ ਸਭ ਮੰਨ ਗਏ ਅਸੀਂ ਪੰਜ ਛੇ ਦੋਸਤ ਵੱਖਰੇ ਵੱਖਰੇ ਸਬਜੈਕਟ ਪੜ੍ਹਾਉਣੇ ਸ਼ੁਰੂ ਕਰ ਦਿੱਤੇ ਅਤੇ ਬਿਜਨਸ ਸ਼ੁਰੂ ਕਰਨ ਦੇ ਲਈ ਸਾਨੂੰ ਇੱਕ ਬਿਲਡਿੰਗ ਦੀ ਲੋੜ ਪੈਣੀ ਸੀ ਸਾਨੂੰ ਕੁਛ ਸਟਾਫ ਦੀ ਲੋੜ ਪੈਣੀ ਸੀ ਇਸ ਕਰਕੇ ਅਸੀਂ ਬੈਂਕ ਗਏ ਅਤੇ ਅਸੀਂ ਇੱਕ ਲੋਨ ਲਿੱਤਾ ਉਹਦੇ 'ਚ ਮੈਂ ਉਹਨਾਂ ਨੂੰ ਆਪਣਾ ਘਰ ਦਿਆਂ ਘਰ ਦਿਖਾਇਆ ਸਭ ਕੁਛ ਦਿਖਾਇਆ ਉਹਨਾਂ ਨੇ ਮੈਨੂੰ ਇੱਕ ਲੋਨ ਦੇ ਦਿੱਤਾ ਅਤੇ ਉਸ ਤੋਂ ਮੈਂ ਬਿਜ਼ਨਸ ਆਪਣਾ ਸ਼ੁਰੂ ਕੀਤਾ ਹੀ ਧੀਰੇ ਧੀਰੇ ਕਰਕੇ ਜਦ ਮੇਰਾ ਬਿਜਨਸ ਵੱਧਦਾ ਗਿਆ ਵੱਧਦਾ ਗਿਆ ਉਸ ਤੋਂ ਬਾਅਦ ਫਿਰ ਮੇਰਾ ਇੱਕ ਆਪਣਾ ਘਰ ਦੀ ਵਾਰੀ ਸੀ ਇਸ ਲਈ ਮੈਂ ਇੱਕ ਘਰ ਦੇ ਲਈ ਇੱਕ ਅਲੱਗ ਤੋਂ ਲੋਨ ਲਿੱਤਾ ਉਹਦੇ ਲਈ ਮੈਂ ਉਹਨਾਂ ਨੂੰ ਪ੍ਰੋਪਰਟੀ ਦਿਖਾਈ ਆਪਣੀ ਕਿ ਮੇਰੇ ਕੋਲ ਆਹ ਜ਼ਮੀਨ ਹੈਗੀ ਆ ਇਹ ਉਹਨਾਂ ਨੂੰ ਮੈਂ ਬੈਂਕ ਵਾਲਿਆਂ ਨੂੰ ਜਾ ਕੇ ਦਿਖਾਇਆ ਇਸ ਇਸ ਕਰਕੇ ਉਹਨਾਂ ਨੇ ਮੈਨੂੰ ਘਰ ਦੇ ਲਈ ਵੀ ਇੱਕ ਲੋਨ ਦਿੱਤਾ ਫਿਰ ਹੌਲੀ ਹੌਲੀ ਕਰਕੇ ਉਹਨਾਂ ਨੂੰ ਮੇਰਾ ਘਰ ਬਣਨਾ ਸ਼ੁਰੂ ਹੋ ਗਿਆ ਅਤੇ ਮੈਂ ਆਪਣੇ ਬਿਜਨਸ ਵੱਲ ਵੀ ਬਹੁਤਾ ਧਿਆਨ ਦੇ ਰਿਹਾ ਸੀ ਉਸ ਤੋਂ ਬਾਅਦ ਫਿਰ ਧੀਰੇ ਧੀਰੇ ਕਰਦੇ ਕਰਦੇ ਮੇਰੇ ਘਰ ਵੀ ਕੰਪਲੀਟ ਹੋ ਗਿਆ ਅਤੇ ਮੈਂ ਇਹਨਾਂ ਨੂੰ ਹਲੇ ਲੋਨ ਦੇ ਰਿਹਾ ਸੀ ਲਾਈਕ ਇਹ ਮੇ ਮੈਂ ਇਹਨਾਂ ਨੂੰ ਲੋਨ ਦੇ ਰਿਹਾ ਸੀਗਾ ਅਤੇ ਮੇਰਾ ਹੁਣ ਘਰ ਕੰਪਲੀਟ ਹੋ ਗਿਆ ਸੀ ਪੰਜ ਛੇ ਸਾਲ ਬਾਅਦ ਮੇਰੀ ਜਿਹੜੀ ਲੋਨ ਸਾਰਾ ਸਾਰਾ ਉਤਰ ਗਿਆ ਸੀ ਹੁਣ ਮੇਰੇ ਲਈ ਬਸ ਇੱਕ ਵਧੀਆ ਜਿਹੀ ਗੱਡੀ ਰਹਿ ਗਈ ਸੀਗੀ ਕਿਉਂਕਿ ਹੁਣ ਮੈਨੂੰ ਇੱਕ ਗੱਡੀ ਚਾਹੀਦੀ ਸੀਗੀ ਹੁਣ ਸ ਮੇਰੀ ਫੈਮਲੀ ਸੀ ਉਹ ਵੱਡੀ ਹੋ ਚੁੱਕੀ ਸੀਗੀ ਅਤੇ ਇੱਕ ਗੱਡੀ ਦੀ ਜ਼ਰੂਰਤ ਸੀ ਇਸ ਲਈ ਮੈਨੂੰ ਆਪਣੀ ਸੇਵਿੰਗ ਦੇਖਣੀ ਪਈ ਇਸ ਲਈ ਮੇਥੋਂ ਪੂਰੇ ਪੈਸੇ ਨਹੀਂ ਮਿਲੇ ਮੈਨੂੰ ਇਸ ਲਈ ਮੈਂ ਇੱਕ ਗੱਡੀ ਲਿਆਉਣ ਲਈ ਫਿਰ ਬੈਂਕ ਤੋਂ ਲੋਨ ਲਿੱਤਾ ਅਤੇ ਉਹਨਾਂ ਨੂੰ ਇੱਕ ਛੇ ਮਹੀਨਿਆਂ ਦਾ ਲੋਨ ਦਿੱਤਾ ਕਿਉਂਕਿ ਮੈਨੂੰ ਬਹੁਤ ਘੱਟ ਪੈਸੇ ਮੈਨੂੰ ਚਾਹੀਦੇ ਸੀਗੇ ਸਿਰਫ਼ ਚਾਰ ਲੱਖ ਚਾਹੀਦੇ ਸੀਗੇ ਇਸ ਲਈ ਮੈਂ ਉਹਨਾਂ ਤੋਂ ਲੋਨ ਲੈ ਲਿਆ ਅਤੇ ਉਹਨਾਂ ਨੂੰ ਮੈਂ ਛੇ ਮਹੀਨਿਆਂ ਵਿੱਚ ਹੀ ਉਤਾਰ ਦਿੱਤਾ ਆਪ ਜੀ ਦਾ ਧੰਨਵਾਦ